ਖੇਡਾਂ ਖੇਡਣ ਨਾਲ਼ ਲੋਕਾਂ ਵਿੱਚ ਆਪਸੀ ਪਿਆਰ ਭਾਵਨਾ ਵਧਦੀ ਹੈ ਸਾਡੇ ਪਿੰਡ ਵਿੱਚ ਗੁਰੂ ਨਾਨਕ ਸਪੋਟਸ ਕਲੱਬ ਬਣਿਆ ਹੋਇਆ ਹੈ ਜਿਸ ਨਾਲ਼ ਸਾਡੇ ਪਿੰਡ ਵਿੱਚ ਦੇ ਪੰਚਾਇਤ ਵੱਲੋਂ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਅਸੀਂ ਨਾਲ਼ ਦੇ ਪਿੰਡਾਂ ਵਿੱਚ ਟੀਮਾਂ ਨੂੰ ਇਨਵਾਈਟ ਕਰਦੇ ਹੈ ਵੋਲੀਵਾਲ ਫੁੱਟਵਾਲ 'ਚ ਅਤੇ ਉਹ ਪਿੰਡ ਲਾਗ ਦੇ ਪਿੰਡਾਂ ਵਾਲੇ ਸਾਡੇ ਪਿੰਡ ਖੇਡਣ ਆਉਂਦੇ ਹਨ ਅਤੇ ਲਾਸ਼ਟ ਵਾਲੇ ਦਿਨਾਂ ਵਿੱਚ ਅਸੀਂ ਪੋਲੀਟੀਸ਼ਨ ਮੰਤਰੀਆਂ ਨੂੰ ਬੁਲਾਉਂਦੇ ਐਮ ਐੱਲ ਏ ਨੂੰ ਬੁਲਾਉਂਦੇ ਹਾਂ ਤਾਂ ਜੋ ਉਹ ਸਾਡੇ ਪਿੰਡ ਵਿੱਚ ਆ ਕੇ ਪਹਿਲਾ ਇਨਾਮ ਵੰਡ ਸਮਾਰੋਹ ਵਿਚ ਹ ਹਾਸਲ ਰਾਤ ਨੂੰ ਹੁੰਦੇ ਆ ਅਤੇ ਉਹ ਸਾਡੇ ਪਿੰਡ ਨੂੰ ਸਪੋਟਸ ਕਲੱਬ ਨੂੰ ਪੰਚਾਇਤ ਨੂੰ ਫੰਡ ਵਗੈਰਾ ਦੇ ਕੇ ਜਾਂਦੇ ਆ